ਭੰਗੜਾ ਐਰੋਵੈਕਸ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦਾ ਇੱਕ ਜੀਵਤ ਰੂਪ ਹੈ ਆਧੁਨਿਕ ਫਿਟਨੈਸ ਰੂਟੀਨ ਦੇ ਨਾਲ ਅ ਰਵਾਇਤੀ ਡਾਂਸ ਤਖਤਾਂ ਨੂੰ ਸਹਿਜੇ ਹੀ ਜੋੜਦਾ ਹੈ ਪੰਜਾਬ ਖੇਤਰ ਦੇ ਊਰਜਾਵਾਨ ਅਤੇ ਜਸ਼ਨ ਮਨਾਉਣ ਵਾਲੇ ਨਾਚ ਵਿੱਚ ਜੜਿਆ ਭੰਗੜਾ ਐਰੋਬੈਕਸ ਅ ਰਵਾਇਤੀ ਲੋਕ ਨਾਚ ਦੇ ਤੱਤਾਂ ਨੂੰ ਸੁਰੱਖਿਅਤ ਰੱਖਦਾ ਹੈ ਅਤੇ ਇਸ ਨੂੰ ਸਮਕਾਲੀ ਤੰਦਰੁਸਤੀ ਦੇ ਉਦੇਸ਼ਾਂ ਲਈ ਢਾਲਦਾ ਹੈ ਭੰਗੜੇ ਦੇ ਸੰਗੀਤ ਦੀਆਂ ਤਾਲਦਾਰ ਬੀਟਾਂ ਜੋ ਕਿ ਜੀਵਤ ਢੋਲ ਦੀਆਂ ਤਾਲਾਂ ਅਤੇ ਸੁਰੀਲੀਆਂ ਧੁਨਾਂ ਦੁਆਰਾ ਦਰਸਾਈਆਂ ਗਈਆਂ ਹਨ ਪੰਜਾਬ ਦੇ ਖੇਤੀਬਾੜੀ ਤਿਉਹਾਰਾਂ ਅਤੇ ਫਿਰਕੂ ਜਸ਼ਨਾਂ ਦੀ ਤਿਉਹਾਰੀ ਭਾਵਨਾ ਨੂੰ ਜਗਾਉਂਦੀਆਂ ਹਨ ਐਰੋਵਿਕ ਰੂਟੀਨ ਵਿੱਚ ਅ ਰਵਾਇਤੀ ਭੰਗੜੇ ਦੇ ਕਦਮਾਂ ਜਿਵੇਂ ਕਿ ਜ਼ੋਰਦਾਰ ਬਾਹਾਂ ਦੀ ਹਰਕਤ ਉੱਚੀ ਛਾਲ ਨੂੰ ਸ਼ਾਮਿਲ ਕਰਕੇ ਇਹ ਅਭਿਆਸ ਫਾਰਮ ਡਾਂਸ ਦੇ ਮੋਲ ਨੂੰ ਸ਼ਰਧਾਂਜਲੀ ਦਿੰਦਾ ਹੈ ਜੋ ਅਸਲ ਵਿੱਚ ਵਾਢੀ ਅਤੇ ਜੀਵਨ ਦੇ ਆਨੰਦਮਈ ਪਲਾਂ ਦਾ ਜਸ਼ਨ ਮਨਾਉਣ ਲਈ ਕੀਤਾ ਗਿਆ ਸੀ ਇਸ ਆਧੁਨਿਕ ਫਿਟਨੈਸ ਪਹੁੰਚ ਵਿੱਚ ਡਾਂਸ ਸਟੈਪਸ ਅਤੇ ਸੰਗੀਤ ਵਿੱਚ ਮੌਜੂਦ ਸੱਭਿਆਚਾਰਕ ਪ੍ਰੀਤੀ ਕਤਾ ਨੂੰ ਸੁਰੱਖਿਅਤ ਰੱਖਿਆ ਗਿਆ ਹੈ ਜਿਸ ਨਾਲ ਭਾਗੀਦਾਰਾਂ ਨੂੰ ਪੰਜਾਬ ਦੇ ਅਮੀਰ ਵਿਰਸੇ ਨਾਲ ਜੁੜਨ ਦੀ ਇਜਾਜ਼ਤ ਮਿਲਦੀ ਹੈ ਭਾਵੇਂ ਉਹ ਸਰੀਰਿਕ ਕਸਰਤ ਵਿਚ ਸ਼ਾਮਿਲ ਹੁੰਦੇ ਹਨ ਇਸ ਤਰ੍ਹਾਂ ਭੰਗੜਾ ਐਰੋਵੈਕਸ ਨਾਲ ਸਿਰਫ਼ ਸਰੀਰਿਕ ਸਿਹਤ ਉਤਸ਼ਾਹਿਤ ਕਰਦਾ ਹੈ ਸਗੋਂ ਪੰਜਾਬ ਦੀਆਂ ਸੱਭਿਆਚਾਰਕ ਪਰੰਪਰਾਵਾਂ ਲਈ ਇੱਕ ਜੀਵਤ ਸ਼ਰਧਾਂਜਲੀ ਵਜੋਂ ਵੀ ਕੰਮ ਕਰਦਾ ਹੈ ਇਸ ਨੂੰ ਤੰਦਰੁਸਤੀ ਅਤੇ ਵਿਰਾਸਤ ਦਾ ਇੱਕ ਵਿਲੱਖਣ ਸੰਯੋਜਨ ਬਣਾਉਂਦਾ ਹੈ